ਹੈਲੋ ਤੁਸੀਂ ਸਵੀਗੀ ਤੋਂ ਬੋਲਦੇ ਓਂ ਜੀ ਮੇਰਾ ਨਾਮ ਗੁਰਪ੍ਰਤਾਪ ਸਿੰਘ ਹੈ ਅਤੇ ਕੁਝ ਸਮਾਂ ਪਹਿਲਾਂ ਮੈਂ ਤੁਹਾਨੂੰ ਔਡਰ ਦਿੱਤਾ ਸੀਗਾ ਜੀ ਅਤੇ ਔਡਰ 'ਚ ਕੜਾਈ ਪਨੀਰ ਸੀਗਾ ਅਤੇ ਦਾਲ ਮੱਖਣੀ ਸੀ ਦਾਲ ਮੱਖਣੀ ਦੇ ਵਿੱਚ ਤੁਸੀਂ ਨੇ ਜੋ ਨਾਲ ਸਾਈਲਡ ਸਾਈਲਡ ਵਗੈਰਾ ਦੋਓਂਗੇ ਉਹਦੇ 'ਤੇ ਨਮਕ ਬਿਲਕੁਲ ਨਾ ਮਾਤਰ ਹੀ ਰੱਖਿਓ ਪਾਇਓ ਹੀ ਨਾ ਅਤੇ ਮੈਂ ਇਸ ਇਸ ਸੰਬੰਧ 'ਚ ਤੁਹਾਨੂੰ ਥੋੜ੍ਹੀਆਂ ਜਿਹੀਆਂ ਹਦਾਇਤਾਂ ਦੇਣੀਆਂ ਚਾਹੁੰਦਾ ਕਿ ਵੀ ਆਪਣਾ ਜਿਵੇਂ ਰੋਟੀ ਹੋ ਗਈ ਰੋਟੀ 'ਤੇ ਬਿਲਕੁਲ ਘਿਓ ਨਾ ਲਾਇਓ ਅਤੇ ਆਪਣਾ ਦਾਲ 'ਚ ਵੀ ਨਮਕ ਜਮਾਂ ਘੱਟ ਰੱਖਿਓ ਅਤੇ ਮਸਾਲੇ ਵਗੈਰਾ ਵੀ ਘੱਟ ਰੱਖਿਓ ਅਤੇ ਜੇ ਤੁਹਾਡੇ ਕੋਲ ਕੋਈ ਇਹੋ ਜਿਹੀ ਵੈੱਬਸਾਈਟ ਜਾਂ ਕੋਈ ਐਪ ਹੈਗੀ ਆ ਜਿਹਦੇ 'ਚ ਮੈਂ ਇਹ ਹਦਾਇਤਾਂ ਤੁਹਾਨੂੰ ਲਿਖ ਕੇ ਜੇ ਤੁਹਾਨੂੰ ਨਹੀਂ ਯਾਦ ਰਹਿੰਦੀਆਂ ਜਾਂ ਮੈਂ ਲਿਖ ਕੇ ਇਹਨਾਂ ਨੂੰ ਉਹ ਕਰ ਸਕਦਾ ਜਾਂ ਮੈਂ ਇਹਦਾ ਕਿਤੇ ਵੀ ਤੁਸੀਂ ਆਪਣੇ ਰਿਕਾਰਡ 'ਚ ਰੱਖ ਸਕਦੇ ਓਂ ਅਤੇ ਬਹੁਤ ਜ਼ਿਆਦਾ ਧੰਨਵਾਦੀ ਹੋਊਂਗਾ ਤੁਹਾਡਾ